ਮੈਂ ਆਪਣੇ ਦਿੱਲੀ ਵਿੱਚ ਅੱਪੂ ਘਰ ਦੇ ਵਿੱਚ ਬੜੇ ਪੰਛੀ ਦੇਖੇ ਪਕਸ਼ੀ ਵੀ ਦੇਖੇ ਉੱਥੇ ਵੱਖਰੇ ਵੱਖਰੇ ਤਰ੍ਹਾਂ ਦੇ ਪੰਛੀ ਪਕਸ਼ੀ ਸਭ ਤਰ੍ਹਾਂ ਦੇ ਜਾਨਵਰ ਵੀ ਹੈਗੇ ਹਨ ਮੈਂ ਚੰਡੀਗੜ੍ਹ ਦੇ ਵਿੱਚ ਛੱਤ ਬੀੜ ਜ਼ੂ ਵਿੱਚ ਵੀ ਗਈ ਸੀ ਉੱਥੇ ਵੀ ਦੇਖੇ ਮੈਂ ਅਲੱਗ ਅਲੱਗ ਤਰ੍ਹਾਂ ਦੇ ਪੰਛੀ ਅਤੇ ਉਹ ਅਲੱਗ ਅਲੱਗ ਤਰ੍ਹਾਂ ਦੇ ਦਾਣੇ ਉਹਨਾਂ ਨੂੰ ਪਾਏ ਜਾਂਦੇ ਹਨ ਔਰ ਉਹਨਾਂ ਦੀ ਜਿਹੜੀ ਸੁੰਦਰਤਾ ਬਹੁਤ ਹੀ ਅੱਛੀ ਹੈ ਉਹ ਬਹੁਤ ਹੀ ਸੋਹਣੇ ਹੈਗੇ ਨੇ ਔਰ ਉਹਨਾਂ ਨੇ ਬੜੀ ਹੀ ਸਫਾਈ ਦੇ ਨਾਲ ਉਹਨਾਂ ਨੂੰ ਰੱਖਿਆ ਹੋਇਆ ਹੈ ਅਤੇ ਮੈਂ ਕਬੂਤਰ ਬਾਜੀ ਵੀ ਦੇਖੀ ਹੈ ਕਬੂਤਰ ਆਪਣੇ ਬੜੇ ਤਰ੍ਹਾਂ ਦੇ ਹੁੰਦੇ ਹਨ ਸਾਡੇ ਘਰ ਦੇ ਬਾਹਰ ਵੀ ਬੜੇ ਤਰ੍ਹਾਂ ਦੇ ਕਬੂਤਰ ਆਪਣਾ ਆਲ੍ਹਣਾ ਬਣਾ ਕੇ ਬੈਠ ਜਾਂਦੇ ਹਨ ਅਤੇ ਮੈਂ ਉਹਨਾਂ ਨੂੰ ਦਾਣਾ ਪਾਨੀ ਆ ਪਾਣੀ ਪਾਨੀ ਆ ਮੇਰੇ ਬੱਚਿਆਂ ਨੇ ਕੁੱਜੇ ਬਣਾ ਕੇ ਰੱਖੇ ਹੋਏ ਹਨ ਉਹਦੇ ਵਿੱਚ ਪਾਣੀ ਪਾ ਦਿੰਦੇ ਹਨ ਸਵੇਰੇ ਉੱਠ ਕੇ ਦਾਣਾ ਪਾ ਦਿੰਦੇ ਹਨ ਅਤੇ ਉਹ ਆਪਣਾ ਬੜੇ ਸੋਹਣੇ ਢੰਗ ਨਾਲ ਆਉਂਦੇ ਹਨ ਅਤੇ ਆਪਣਾ ਭੋਜਨ ਕਰਦੇ ਹਨ ਜਦੋਂ ਮੈਂ ਦਿੱਲੀ ਗਈ ਸੀ ਅੱਪੂ ਘਰ ਦੇ ਵਿੱਚ ਉੱਥੇ ਪੰਛੀ ਬੰਦ ਕਰਕੇ ਰੱਖੇ ਹੋਏ ਸੀ ਔਰ ਉਹ ਆਪਣਾ ਉੱਡਦੇ ਸੀਗੇ ਬੜਾ ਸੋਹਣੀ ਢੰਗ ਨਾਲ ਅਤੇ ਉਹਨਾਂ ਅਤੇ ਬੜਾ ਹੀ ਵਧੀਆ ਲੱਗ ਰਿਹਾ ਸੀ ਜਦੋਂ ਉਹ ਉੱਡਦੇ ਸੀ ਅਲੱਗ ਅਲੱਗ ਰੰਗਾਂ ਦੇ ਪਕਸ਼ੀ ਸੀਗੇ ਕੋਈ ਪੀਲਾ ਕੋਈ ਨੀਲਾ ਕੋਈ ਸਫੇਦ ਕੋਈ ਮਜੰਟਾ ਰੰਗ ਦਾ ਬੜਾ ਹੀ ਪਿਆਰਾ ਸੀ ਹਾਂ ਧੰਨਵਾਦ